ਸਾਡੇ ਕੋਲ ਕਾਫੀ ਮੱਝਾਂ ਗਾਵਾਂ ਹਨ ਇਹਨਾਂ ਦੀ ਦੇਖਭਾਲ ਕਰਨ ਲਈ ਅਸੀਂ ਇੱਕ ਬੰਦਾ ਰੱਖਿਆ ਹੋਇਆ ਹੈ ਅਤੇ ਅਸੀਂ ਸਾਰਾ ਪਰਿਵਾਰ ਚਾਚੇ ਤਾਏ ਮਿਲ ਕੇ ਇਸ ਦੀ ਦੇਖਭਾਲ ਕਰਦੇ ਹਨ ਸ ਸਵੇਰ ਦੇ ਟਾਈਮ ਅਸੀਂ ਸਭ ਤੋਂ ਪਹਿਲਾਂ ਇਹਨਾਂ ਦਾ ਦੁੱਧ ਚੋਅ ਕੇ ਉਸ ਤੋਂ ਬਾਅਦ ਇਹਨਾਂ ਨੂੰ ਚੋਅ ਕੇ ਅਸੀਂ ਇਕੱਠਾ ਕਰ ਲੈਂਦੇ ਹਨ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਹਰਾ ਚਾਰਾ ਤੂੜੀ ਖਵਾ ਕੇ ਖੁਆ ਦਿੰਦੇ ਹਾਂ ਉਸ ਤੋਂ ਬਾਅਦ ਅਸੀਂ ਇਸ ਨੂੰ ਨਵੋਣ ਧੋਣ ਲਈ ਅਸੀਂ ਪਿੰਡ ਤੋਂ ਬਾਹਰ ਨਹਿਰ 'ਤੇ ਲੈ ਜਾਂਦੇ ਹਾਂ ਅਤੇ ਅਸੀਂ ਇਸ ਦੀ ਸਾਫ ਸਫਾਈ ਉਸ ਤੋਂ ਬਾਅਦ ਅਸੀਂ ਇਸ ਨਹਿਰ ਤੋਂ ਲੈ ਜਾਣ ਤੋਂ ਬਾਅਦ ਘਰ ਦੇ ਮੈਂਬਰ ਇਸ ਦੀ ਸਾਫ ਸਫਾਈ ਮੂਤ ਗੋਹਾ ਸਾਰਾ ਇਕੱਠਾ ਕਰਕੇ ਇੱਕ ਜਗ੍ਹਾ ਰੱਖ ਦਿੰਦੇ ਰੱਖ ਦਿੰਦੇ ਹਾਂ ਗੋਹਾ ਇਕੱਠਾ ਕਰ ਕਰ ਇਹ ਘੁੰਮ ਫਿਰ ਕੇ ਆਉਣ ਤੋਂ ਬਾਅਦ ਇਸ ਨੂੰ ਅਸੀਂ ਖਾਦ ਹਰਾ ਚਾਰਾ ਅਤੇ ਤੂੜੀ ਪਾਉਂਦੇ ਹਾਂ ਇਸ ਤੋਂ ਬਾਅਦ ਅਸੀਂ ਸ਼ਾਮ ਨੂੰ ਇੱਕ ਵਾਰੀ ਇਸਦਾ ਮਿਲਕ ਕਡਕ ਕੱਢਣ ਤੋਂ ਬਾਅਦ ਇਸ ਦੇ ਖੇਤਰ ਦੀ ਏਰੀਏ ਦੀ ਸਫਾਈ ਗੋਹਾ ਵਗੈਰਾ ਇਕੱਠਾ ਕਰਕੇ ਬਾਇਓ ਗੈਸ ਪਲਾਂਟ ਦੇ ਵਿੱਚ ਪਾ ਦਿੰਦੇ ਹਾਂ ਅਤੇ ਜੋ ਉਸਦਾ ਵੇਸਟਿੰਗ ਹੁੰਦਾ ਹੈ ਅਸੀਂ ਉਸਦੀ

ਬਾਇਓ ਕਪੋਸਟ ਖਾਦ ਬਣਾ ਲੈਂਦੇ ਹਾਂ ਜੋ ਕਿ ਖੇਤਾਂ ਵਿੱਚ ਨਿਊਟਰੀਸ਼ਨ ਦੀ ਕਮੀ ਨੂੰ ਪੂਰਾ ਕਰਦਾ ਹੈ ਇਸ ਦੇ ਨਾਲ ਸਾਡੀਆਂ ਫਸਲਾਂ ਬਹੁਤ ਹਰੀਆਂ ਭਰੀਆਂ ਨਜ਼ਰ ਆਉਂਦੀਆਂ ਹਨ ਅਤੇ ਕੀਟਾਣੂ ਰਹਿਤ ਹੁੰਦੀਆਂ ਹਨ